ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਗਰੀਨ ਵੈਜੀਟੇਬਲ ਵੱਲੋ ਬੋਲਦੇ ਹੋ ਜੀ ਬਰਨਾਲਾ ਤੋਂ ਸਾਨੂੰ ਨਾ ਸਾਡੇ ਗਵਾਂਢ 'ਚ ਕਿਸੇ ਦੇ ਵਿਆਹ ਸੀਗਾ ਸਾਨੂੰ ਉਹਨਾਂ ਤੋਂ ਮਿਲਿਆ ਸੀ ਤੁਹਾਡਾ ਨੰਬਰ ਉਹਨਾਂ ਤੋਂ ਮਤਲਬ ਉਹਨਾਂ ਦੇ ਵਿਆਹ ਸੀਗਾ ਅਤੇ ਅਸੀਂ ਉਹਨਾਂ ਤੋਂ ਪੁੱਛਿਆ ਸੀਗਾ ਵੀ ਤੁਹਾਡੇ ਸਬਜ਼ੀ ਤੁਸੀਂ ਕਿਹਨਾਂ ਤੋਂ ਖਰੀਦੀ ਸੀਗੀ ਅਸੀਂ ਉਹਨਾਂ ਤੋਂ ਲਿੱਤਾ ਸੀ ਤੁਹਾਡਾ ਨੰਬਰ ਉਹ ਕਹਿ ਸਬਜ਼ੀ ਵਧੀਆ ਲ ਬਣੀ ਸੀਗੀ ਵਧੀਆ ਲੱਗੀ ਸਾਨੂੰ ਅਸੀਂ ਸਾਡੇ ਵਿਆਹ ਦਾ ਜੀ ਸਾਨੂੰ ਵਾਹਵਾ ਸਬਜ਼ੀਆਂ ਚਾਹੀਦੀਆਂ ਨੇ ਤੁਹਾਡੇ ਕਿਹੜੀ ਕਿਹੜੀ ਸਬਜ਼ੀ ਮਿਲ ਜੂ ਹਾਂ

ਤਾਂ ਤੁਹਾਡਾ ਮੈਂ ਉਹ ਤੁਸੀਂ ਬਰਨਾਲਾ 'ਚ ਮਤਲਬ ਤੁਹਾਡਾ ਉਹ ਸ਼ੋਪ ਹਾਂ ਤੁਹਾਡੀ ਸ਼ੋਪ ਕਿੱਥੇ ਜੇ ਹੈਗੀ ਐਡਰੈਸ ਦੇ ਦਿਓ ਤੁਹਾਡੇ ਸਾਨੂੰ ਕਾਫੀ ਸਬਜ਼ੀਆਂ ਚਾਹੀਦੀਆਂ ਨੇ ਤਿੰਨ ਚਾਰ ਦਿਨ ਲਈ ਵਿਆਹ ਨਾ ਸਾਡੇ ਉਹਦੇ ਕਰਕੇ ਜਿਵੇਂ ਪਨੀਰ ਪਨੀਰ ਵਗੈਰਾ ਮਿਲ ਜਾਂਦਾ ਤੁਹਾਡੇ ਗੋਭੀ ਹੋ ਗਈ ਗਾਜਰਾਂ ਹੋ ਗਈਆਂ ਮਟਰ ਹੋ ਗਏ ਟਮਾਟਰ ਪਿਆਜ਼ ਵਗੈਰਾ ਸਾਰਾ ਹਰੀਆਂ ਮਿਰਚਾਂ ਵਗੈਰਾ ਸਾਰਾ ਔਰ

ਵਧੀਆ ਹੁੰਦੇ ਨੇ ਤੁਸੀਂ ਖੁਦ ਵੀ ਉਗਾਨੇ ਹੋ ਜੀ

ਸਾਈਡ ਇਫੈਕਟ ਤਾਂ ਨਹੀਂ ਹੋਣਾ ਮਤਲਬ ਇੱਦਾਂ ਕੋਈ ਖਰਾਬ ਖਰੂਬ ਨਹੀਂ ਹੁੰਦੀਆਂ ਨਾ ਅਤੇ ਅਤੇ ਫਿਰ ਤੁਸੀਂ ਸਾਡੇ ਵਿਆਹ ਗਾ ਮਤਲਬ ਹਲੇ ਵੈਸੇ ਪਿਆ ਗਾ ਹਫਤਾ ਤੁਸੀਂ ਸਾਨੂੰ ਅਸੀਂ ਤੁਹਾਡੇ ਤੋਂ ਲੈ ਜਾਂਗੇ ਮਤਲਬ ਤਿੰਨ ਚਾਰ ਦਿਨ ਪਹਿਲਾਂ ਹੀ ਲੈ ਜਾਂਗੇ ਠੀਕ ਹੈ ਮਤਲਬ ਤੁਸੀਂ ਨਾ ਪਨੀਰ ਟਮਾਟਰ ਮਟਰ ਵਗੈਰਾ ਸਬਜ਼ੀਆਂ ਹੈ ਨਾ ਜਿਹੜੀਆਂ ਵਿਆਹ ਸ਼ਾਦੀਆਂ 'ਚ ਆਮ ਹੀ ਲੋਕ ਲਿਜਾਂਦੇ ਹੈਗੇ ਹੈ ਨਾ ਉਹ ਤੁਸੀਂ ਰੱਖਿਓ ਠੀਕ ਆ ਵਾਹਵਾ ਸਟੋਕ ਰੱਖਿਓ ਅਤੇ ਅਸੀਂ ਤੁਹਾਡੇ ਤੋਂ ਲੈ ਜਾਂਗੇ ਅਤੇ ਸਾਨੂੰ ਪਾ ਪੈਸੇ ਉਹਨਾਂ ਦੇ ਦੱਸ ਦਿਓ ਅਸੀਂ ਤੁਹਾਨੂੰ ਉਦੋਂ ਹੀ ਨਕਦ ਦੀ ਲੈ ਜਾਂਗੇ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ